ਇਹ ਗੱਲ ਮਾਰਚ ਵੀਹ ਸੌ ਵੀਹ ਦੀ ਹੈ ਜਦੋਂ ਪੂਰਾ ਵਿਸ਼ਵ ਕਰੋਨਾ ਦੀ ਮਾਰ ਹੇਠਾਂ ਸੀ ਉਸ ਦਾ ਅਸਰ ਹਰ ਕਿੱਤੇ ਅਤੇ ਹਰ ਪਹਿਲੂ 'ਤੇ ਦੇਖਣ ਨੂੰ ਮਿਲ ਸਕਦਾ ਸੀ ਉਸੇ ਤਰ੍ਹਾਂ ਉਸ ਦਾ ਅਸਰ ਸਾਡੇ ਖੇਤਰ ਵਿੱਚ ਵੀ ਕਾਫੀ ਭਿਆਨਕ ਰੂਪ ਵਿੱਚ ਦੇਖਣ ਨੂੰ ਮਿਲਿਆ ਸਾਡੇ ਖੇਤਰ ਵਿੱਚ ਕਰੋਨਾ ਦੇ ਕਈ ਕੇਸ ਆਏ ਅਤੇ ਮੌਤਾਂ ਵੀ ਹੋਈਆਂ ਸਾਡੇ ਪਿੰਡ ਵਿੱਚ ਇਸ ਨਾਲ ਖੇਤੀ 'ਤੇ ਵੀ ਅਸਰ ਵੇਖਣ ਨੂੰ ਮਿਲਿਆ ਜਿਵੇਂ ਕਿ ਸਬਜ਼ੀਆਂ ਦਾ ਮੰਡੀਕਰਨ ਵਿੱਚ ਰੋਜ਼ਾਨਾ ਦੀ ਦਿੱਕਤ ਅਤੇ ਕਣਕ ਦੀ ਵਢਾਈ ਸਮੇਂ ਢਵਾਈ ਸਮੇਂ ਲੇਬਰ ਦੀ ਦਿੱਕਤ ਆਈ